ਹਾਂਜੀ ਮੈਂ ਤਸਵੀਰਾਂ ਲੈਣ ਲਈ ਕਾਫੀ ਜਗ੍ਹਾ ਯਾਤਰਾ ਕੀਤੀਆਂ ਨੇ ਹੁਣ ਥੋੜ੍ਹੇ ਦਿਨ ਪਹਿਲਾਂ ਜਦੋਂ ਮੇਰੀ ਛੁੱਟੀਆਂ ਹੋਈਆਂ ਸੀਗੀਆਂ ਮੈਂ ਦੇਹਰਾਦੂਨ ਗਈ ਸੀਗੀ ਉੱਥੇ ਮੈਨੂੰ ਕਾਫੀ ਵਧੀਆ ਸਪੋਟਸ ਮਿਲੇ ਫੋਟੋਸ ਖਿੱਚਣ ਲਈ ਔਰ ਤਸਵੀਰਾਂ ਜਿਹੜੀਆਂ ਮੈਂ ਉੱਥੇ ਖਿੱਚੀਆਂ ਉਹ ਬਹੁਤ ਹੀ ਜ਼ਿਆਦਾ ਵਧੀਆ ਨਿਕਲ ਕੇ ਆਈਆਂ ਨੇ ਅਤੇ ਜਿੱਦਾਂ ਦੇਹਰਾਦੂਨ ਉੱਥੇ ਵਾਈਡ ਲਾਈ ਜਿੱਥੇ ਉੱਥੇ ਨੈਸ਼ਨਲ ਪਾਰਕ ਵੀ ਨੇ ਉੱਥੇ ਉੱਥੇ ਦੇ ਮੈਂ ਕਾਫੀ ਵਧੀਆ ਵਧੀਆ ਫੋਟੋਸ ਖਿੱਚੀਆਂ ਨੇ ਹੋਰ ਮੈਂ ਉਹ ਤੋਂ ਪਹਿਲਾਂ ਮੈਂ ਕਸ਼ਮੀਰ ਗਈ ਸੀਗੀ ਫਿਰ ਮੈਂ ਸ਼ਿਮਲਾ ਗਈ ਸੀਗੀ ਉੱਥੇ ਵੀ ਕਾਫੀ ਵਧੀਆ ਸਪੋਟਸ ਨੇ ਪਿਚਰ ਖਿੱਚਣ ਲਈ ਅਤੇ ਹੁਣ ਅੱਗੇ ਮੈਂ ਜਾਣਾ ਚਾਹੂੰਗੀ ਦਿੱਲੀ ਦਿੱਲੀ ਤੋਂ ਬਾਅਦ ਮੁੰਬਈ ਅਤੇ ਹੋਰ ਵੀ ਇੱਥੇ ਭਾਰਤ ਦੇ ਕਾਫੀ ਸਾਰੇ ਸਟੇਟਸ ਨੇ ਜਿੱਥੇ ਕਾਫੀ ਵਧੀਆ ਵਧੀਆ ਸਪੋਰਟਸ ਨੇ ਸਾਡੇ ਲਈ ਅਤੇ ਜੇ ਭਾਰਤ ਤੋਂ ਬਾਹਰ ਜਾਣ ਦੀ ਗੱਲ ਕਰੀਏ ਤਾਂ ਮੈਂ ਥਾਈਲੈਂਡ ਅਤੇ ਚਾਈਨਾ ਜ਼ਰੂਰ ਜਾਣਾ ਚਾਹੂੰਗੀ ਉੱਥੇ ਦੇ ਜਿਹੜੇ ਸਪੋਰਟਸ ਦੀ ਜਿਹੜੇ ਉੱਥੇ ਦੀ ਨੇਚਰ ਜਿਹਨੂੰ ਆਪਾਂ ਕਹਿ ਲਈਏ ਉੱਥੇ ਦਾ ਵਾਤਾਵਰਨ ਹੈ ਉੱਥੇ ਦੀ ਜਿਹੜੀਆਂ ਸਾਡੀਆਂ ਤਸਵੀਰਾਂ ਆਉਣਗੀਆਂ ਉਹ ਕਾਫੀ ਵਧੀਆ ਆਉਣਗੀਆਂ ਮੈਂ ਉਹਨਾਂ ਨੂੰ ਓਨਲਾਈਨ ਦੇਖਿਆ ਸੀਗਾ ਉਹ ਸਪੋਟਸ ਨੂੰ ਉਹ ਕਾਫੀ ਵਧੀਆ ਸੀਗੇ ਮੈਨੂੰ ਕਾਫੀ ਜ਼ਿਆਦਾ ਪਸੰਦ ਆਏ ਨੇ ਅਤੇ ਹੁਣ ਮੈਂ ਅੱਗੇ ਟਰਾਈ ਕਰਾਂਗੀ ਕਿ ਮੈਂ ਉੱਥੇ ਜਾਵਾਂ ਅਤੇ ਉੱਥੇ ਦੀਆਂ ਤਸਵੀਰਾਂ ਖਿੱਚਾਂ ਧੰਨਵਾਦ